ਦੇਖੋ ਜੀ ਜਦ ਵੀ ਮੈਂ ਆਪਣੀ ਦੌੜ ਦੀ ਤਿਆਰੀ ਕਰਦਾ ਜੀ ਇੱਕ ਤਾਂ ਮੈਂ ਉਸ 'ਚ ਜੀ ਮੈਂ ਆਪਣੀ ਡਾਈਟ ਨੂੰ ਬਹੁਤ ਹੀ ਪਰੋਪਰ ਤਰੀਕੇ ਨਾਲ਼ ਰੱਖਦਾ ਜੀ ਡਾਈਟ 'ਚ ਜਿਵੇਂ ਕਿ ਜੀ ਮੈਂ ਜ਼ੋਰ ਵਾਲੀਆਂ ਚੀਜ਼ਾਂ ਰੱਖਦਾ ਜਿਵੇਂ ਕਿ ਪੰਜਾਬ ਦੀਆਂ ਬਹੁਤ ਹੀ ਪ੍ਰਫੁੱਲਿਤ ਚੀਜ਼ਾਂ ਹੈ ਜੀ ਛੋਲੇ ਹੋ ਗਏ ਜੀ ਦਾਲ਼ਾਂ ਹੋ ਗਈਆਂ ਇਨ੍ਹਾਂ ਨੂੰ ਰਾਤ ਨੂੰ ਭਿਉਂ ਕੇ ਜੀ ਸਵੇਰ ਨੂੰ ਖਾਣਾ ਹੈ ਨਾ ਅਤੇ ਬਾਕੀ ਤਿਆਰੀ ਕਰਨੀ ਹੈ ਜੀ ਹਾਰਡ ਵਰਕ ਕਰਨਾ ਰਨਿੰਗ ਕਰਨੀ ਜੀ ਸਵੇਰੇ ਸ਼ਾਮ ਅਤੇ ਇਸ ਨਾਲ਼ ਐਵੇਂ ਹੈ ਜੀ ਇੱਕ ਤਾਂ ਸਰੀਰ ਫਿੱਟ ਰਹਿੰਦਾ ਨੰਬਰ ਦੋ ਗਰਮੀ ਨਿਕਲਦੀ ਹੈ ਅਤੇ ਨੰਬਰ ਤਿੰਨ ਜੀ ਇਸ ਨਾਲ਼ ਐਂਵੇ ਹੈ ਜੀ ਸਰੀਰ 'ਚ ਜ਼ੋਰ ਵੀ ਬਹੁਤ ਹੁੰਦਾ ਹੈ ਧੰਨਵਾਦ ਜੀ